ਸੰਗੀਤ ਨਾਲ ਸ਼ੁਰੂ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਲਗਾਅ ਰਿਹਾ ਹੈ ਅੱਜ ਤੱਕ ਵੀ ਮੈਂ ਸੰਗੀਤ ਜਦੋਂ ਵੀ ਸੁਣਦਾ ਸੰਗੀਤ ਬਾਰੇ ਖਬਰਾਂ ਸੁਣਦਾ ਸੰਗੀਤ ਸੁਣਦਾ ਤਾਂ ਮੇਰੇ ਦਿਲ ਸਰੀਰ ਅੰਦਰ ਇੱਕ ਲਹਿਰ ਜਿਹੀ ਉੱਠ ਪੈਂਦੀ ਹੈ ਸ਼ੁਰੂ ਵਿੱਚ ਜਦੋਂ ਮੈਂ ਕੋ ਛੋਟੇ ਹੁੰਦਿਆਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਹਰ ਸ਼ਨੀਵਾਰ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਜਾਂਦਾ ਸੀ ਜਿਸਨੂੰ ਬਾਲ ਸਭਾ ਕਹਿੰਦੇ ਸੀ ਬਾਲ ਸਭਾ ਅੰਦਰ ਅ ਸੋ ਹਰੇਕ ਬੱਚੇ ਤੋਂ ਕੋਈ ਵੀ ਐਕਟੀਵਿਟੀ ਕਰਨ ਲਈ ਕਿਹਾ ਜਾਂਦਾ ਸੀ ਕੋਈ ਸਿੰਗਿੰਗ ਲਈ ਡਾਂਸਿੰਗ ਲਈ ਜਾਂ ਕੋਈ ਵੀ ਐਕਟੀਵਿਟੀ ਮੈਂ ਉਸ ਦੇ ਅੰਦਰ ਸਿੰਗਿੰਗ ਕਰਦਾ ਹੁੰਦਾ ਸੀ ਅਤੇ ਆਏ ਸ਼ਨੀਵਾਰ ਮੇਰਾ ਇਹ ਮੇਰੇ ਦਿਲੋਂ ਇਹ ਇੱਛਾ ਹੁੰਦੀ ਸੀ ਕਿ ਮੈਂ ਸ਼ ਆਏ ਸ਼ਨੀਵਾਰ ਕੋਈ ਕੋਈ ਵੀ ਸੌਂਗ ਗਾਵਾਂ ਉਹਨਾਂ ਨੂੰ ਉਦਾਹਰਨ ਵਜੋਂ ਮੇਰੀ ਰੁਚੀ ਇਸ ਤਰ੍ਹਾਂ ਵਧੀ ਮੈਨੂੰ ਸੰਗੀਤ ਵੱਲ ਇਸ ਤਰ੍ਹਾਂ ਖਿੱਚ ਪੈਦਾ ਹੋਈ ਸਾਡੇ ਟੀਚਰ ਸਾਹਿਬਾਨ ਸਾਨੂੰ ਸ਼ਨੀਵਾਰ ਗਿਫ਼ਟ ਦੇ ਵਜੋਂ ਤੋਹਫਾ ਦਿੰਦੇ ਜਾਂ ਸੌ ਰੁਪਏ ਜਾਂ ਕੋਈ ਵੀ ਇ ਇਸ ਤਰ੍ਹਾਂ ਦਾ ਗਿਫ਼ਟ ਦਿੰਦੇ ਜਿਸ ਨਾਲ ਮੈਨੂੰ ਉਤਸ਼ਾਹ ਹੋਰ ਵੀ ਜ਼ਿਆਦਾ ਵਧੀਆ ਹੋਇਆ ਇੱਥੋਂ ਤੱਕ ਆਉਂਦੇ ਆਉਂਦੇ ਵੱਡੀਆਂ ਕਲਾਸਾਂ ਫਿਰ ਮੈਂ ਪਾ ਹਰੇਕ ਅ ਕਲਾਸਾਂ ਜਿਵੇਂ ਪੰਜਵੀਂ ਦੀ ਪਾਰਟੀ ਹੋ ਗਈ ਅੱਠਵੀਂ ਕਲਾਸ ਦੀ ਪਾਰਟੀ ਹੋ ਗਈ ਫਿਰ ਦਸਵੀਂ ਵੇਲੇ ਫਿਰ ਪਲਸ ਟੂ ਵੇਲੇ ਮੈਂ ਹਰੇਕ ਪਾਰਟੀ ਦੇ ਉੱਪਰ ਆਪਣਾ ਪਰਫੋਰਮੈਂਸ ਕਰਦਾ ਗਾਣਾ ਗਾਉਂਦਾ ਅਤੇ ਮੇਰਾ ਉਤਸ਼ਾਹ ਟੀਚਰਾਂ ਅਤੇ ਮੇਰੇ ਦੋਸਤਾਂ ਮਿੱਤਰਾਂ ਮੇਰੇ ਮਾਪਿਆਂ ਨੇ ਹੋਰ ਵੀ ਜ਼ਿਆਦਾ ਵਧਾਇਆ ਜਿਸ ਕਾਰਨ ਮੈਨੂੰ ਸੰਗੀਤ ਨਾਲ ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਸੰਗੀਤ ਮੇਰੇ ਹਰੇਕ ਪਾਰਟ ਵਿੱਚ ਰਚ ਗਿਆ ਸੰਗੀਤ ਨਾਲ ਮੈਨੂੰ ਇੱਕ ਅਜਿਹੀ ਖੁਸ਼ੀ ਮਿਲਦੀ ਹੈ ਜੋ ਕਿ ਕਿਸੇ ਹੋਰ ਵੀ ਚੀਜ਼ ਤੋਂ ਨਹੀਂ ਮਿਲਦੀ ਸੰਗੀਤ ਹੈ ਜਿਹੜਾ ਇਹ ਮੇਰੀ ਲਾਈਫ ਦਾ ਇੱਕ ਅਜਿਹਾ ਪਾਰਟ ਬਣ ਚੁੱਕਾ ਕਿ ਜੇਕਰ ਮੈਂ ਕਦੇ ਵੀ ਸੰਗੀਤ ਨਾ ਸੁਣਾਂ ਜਾਂ ਸੰਗੀਤ ਨਾ ਗਾਵਾਂ ਤਾਂ ਮੈਨੂੰ ਇੱਕ ਤਰ੍ਹਾਂ ਦਾ ਮ ਹੋਰ ਮਹਿਸੂਸ ਹੋਣ ਲੱਗ ਜਾਂਦਾ ਹੈ ਮੈਨੂੰ ਸਭ ਤੋਂ ਜ਼ਿਆਦਾ ਸਤਿੰਦਰ ਸਰਤਾਜ ਜੀ ਦੇ ਗਾਣੇ ਸਿੱਧੂ ਮੂਸੇਵਾਲਾ ਜੀ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਲੱਗਦੇ ਸਨ ਅਤੇ ਮੈਂ ਅੱਜ ਵੀ ਉਹਨਾਂ ਦੇ ਗਾਣਿਆਂ ਤੋਂ ਇੰਸਪਾਇਰ ਹੁੰਦਾ ਅਤੇ ਨਾਲ ਦੇ ਨਾਲ ਮੈਂ ਸਿੰਗਿੰਗ ਬਾਰੇ ਹੋਰ ਵੀ ਜ਼ਿਆਦਾ ਗ੍ਰਹਿਣ ਕਰ ਰਿਹਾ ਹਾਂ ਅਤੇ ਅੱਗੇ ਦੀ ਅੱਗੇ ਹੋਰ ਲੋਕਾਂ ਨੂੰ ਵੀ ਮੋਟੀਵੇਟ ਕਰ ਰਿਹਾ ਹਾਂ